ਮੈਨੂੰ ਇੱਕ ਵਾਰ ਸਕੂਲ ਵਿੱਚ ਮੂਰਤੀ ਬਣਾਉਣ ਲਈ ਕਿਹਾ ਗਿਆ ਪਰ ਉਹ ਮੈਨੂੰ ਮੂਰਤੀ ਬਣਾਉਣੀ ਨਹੀਂ ਸੀ ਆਉਂਦੀ ਉਸ ਮੂਰਤੀ ਨੂੰ ਬਣਾਉਣ ਲਈ ਮੈਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਕਿ ਮੈਂ ਉਹ ਮੂਰਤੀ ਬਹੁਤ ਔਖੀ ਬਣਾਈ ਇਸ ਤੋਂ ਪ੍ਰੇਰਨਾ ਇਹ ਮਿਲਦੀ ਹੈ ਕਿ ਕੋਸ਼ਿਸ਼ ਕਰਨ ਨਾਲ ਹੀ ਸਾਰੇ ਕੰਮ ਹੋ ਸਕਦੇ ਹਨ ਹਮੇਸ਼ਾਂ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੁੰਦੇ ਹਾਂ ਥੈਂਕ ਯੂ